ਸਾਡੇ ਘਰ ਲਾਗੇ ਹੁਣ ਇਕ ਮਿੱਲ ਖੁੱਲ੍ਹ ਚੁੱਕੀ ਹੈ ਜਿਹਦੇ ਵਿੱਚ ਗੁੜ ਅਤੇ ਹੋਰ ਵੀ ਮਿੱਠੀਆ ਚੀਜ਼ਾਂ ਬਣਾਇਆ ਜਾਂਦੀਆਂ ਹਨ ਗੁੜ ਬਣਾਉਣ ਵਾਸਤੇ ਗੰਨਿਆਂ ਨੂੰ ਵੀ ਪੈਦਾ ਕੀਤਾ ਹਨ ਕੀਤਾ ਜਾਂਦਾ ਹੈ ਅਤੇ ਕੋਈ ਗੰਨੇ ਸਾਡੇ ਸਾਡੇ ਘਰ ਦੇ ਲਾਗੇ ਪੈਲੀਆਂ ਬਣੀਆਂ ਹਨ ਅਤੇ ਉੱਥੋਂ ਹੀ ਆਉਂਦੇ ਹਨ ਅਤੇ ਗੰਨੇ ਬਣਾਉਣ ਵਾਸਤੇ ਜਿਹੜੀ ਉੱਥੇ ਫੈਕਟਰੀਆਂ ਲਾਦੀ ਲਾਈਆਂ ਗਈਆਂ ਨੇ ਉਹ ਤਾਂ ਬਹੁਤ ਹੀ ਵੱਡੇ ਸੈਜ ਦੀਆਂ ਹਨ ਇਸ ਪਰ ਜਦੋਂ ਗੁੜ ਨੂੰ ਬਣਾਇਆ ਜਾਂਦਾ ਹਨ ਮਿੱਠੀ ਸ਼ੂਗਰ ਨੂੰ ਬਣਾਇਆ ਜਾਂਦਾ ਹਨ ਉਹ ਨੂੰ ਬਣਾਉਣ ਵਾਸਤੇ ਬੜੀ ਜ਼ਿਆਦਾ ਆਵਾਜ਼ਾਂ ਵੀ ਉੱਥੋਂ ਆਉਂਦੀਆਂ ਹਨ ਜਿਹਦੇ ਕਾਰਨ ਉੱਥੇ ਬਹੁਤ ਹੀ ਘੱਟ ਜਾਨਵਰ ਜੁਨਵਰ ਰਹਿੰਦੇ ਹਨ ਅਤੇ ਲੋਕਾਂ ਨੂੰ ਵੀ ਸਮਝ ਆ ਗਿਆ ਹੈ ਕਿ ਗੁੜ ਬਣਾਉਣ ਵਾਸਤੇ ਬਹੁਤ ਜ਼ਿਆਦਾ ਮਿਹਨਤ ਵੀ ਕਰਨੀ ਪੈਂਦੀ ਹਨ ਕਿਉਂਕਿ ਉਸ 'ਤੇ ਉਸ ਜਗ੍ਹਾ 'ਤੇ ਬਹੁਤ ਹੀ ਜ਼ਿਆਦਾ ਲੋਕ ਕੰਮ ਕਰਦੇ ਹਨ ਇਹ ਲੋਕਾਂ ਨੂੰ ਤਨਖਾਹ ਵੀ ਵਾਹਵਾ ਮਿਲੀ ਜਾਂਦੀ ਹਨ ਪਰ ਪਰ ਮਿਹਨਤ ਲਈ ਬੜੀ ਕਰਦੇ ਹਨ ਗੁੜ ਬਣਾਉਣ ਵਾਸਤੇ ਲੋਕ ਆਪਣੀ ਪੂਰੀ ਜਾਨ ਲਾ ਦਿੰਦੇ ਹਨ ਲੋਕਾਂ ਨੂੰ ਗੁੜ ਉੱਥੋਂ ਖਰੀਦਣ ਵੇਲੇ ਸਸਤਾ ਵੀ ਮਿਲਦਾ ਹਨ ਪਰ ਜਦੋਂ ਉਹ ਗੁੜ ਸ਼ਹਿਰਾਂ ਵਿੱਚ ਜਾਂਦਾ ਹਨ ਤਾਂ ਲੋਕ ਉੱਥੇ ਫਿਰ ਮਹਿੰਗਾ ਰੇਟ ਕਰ ਦਿੰਦੇ ਹਨ ਤਾਂ ਕਿ ਲੋਕ ਇਹ ਸਸਤੇ ਰੇਟ 'ਤੇ ਗੁੜ ਨਾ ਖਰੀਦ ਸਕੇ ਅਤੇ ਮਹਿੰਗੇ ਰੇਟ 'ਤੇ ਖਰੀਦੇ ਤਾਂ ਕਿ ਉੱਥੇ ਤੇ ਲੋਕਾਂ ਨੂੰ ਉੱਥੇ ਕਮਾਈ ਵੀ ਹੋਏ ਵਧੀਆ ਤਰ੍ਹਾਂ ਦੀ ਗੁੜ ਨਾਲ ਅੱਗੇ ਅੱਗੇ ਉੱਥੇ ਬਹੁਤ ਹੀ ਕੋਮਨ ਚੀਜ਼ ਹੋ ਚੁੱਕੀ ਹਨ ਕਿਉਂਕਿ ਉਸ 'ਤੇ ਗੁੜ ਦੀ ਫੈਕਟਰੀ ਕਾਰਨ ਉਤਪਾਦਨ ਬਹੁਤ ਹੀ ਜ਼ਿਆਦਾ ਵਧੀ ਜਾ ਰਿਹਾ ਹੈ ਲੋਕ ਉੱਥੋਂ ਗੁੜ ਨੂੰ ਬਾਹਰਲੀਆਂ ਸਟੇਟਾਂ ਵਿੱਚ ਵੀ ਭੇਜਦੇ ਹਨ ਤਾਂ ਕਿ ਲੋਕ ਉੱਥੇ ਵੀ ਪੰਜਾਬ ਦਾ ਗੁੜ ਚੱਖਣ ਅਤੇ ਉੱਥੇ ਵੀ ਗੁੜ ਪੰਜਾਬ ਦੇ ਗੁੜ ਦੀ ਡਿਮਾਂਡ ਵਧੀ ਜਾਏ ਅਤੇ ਲੋਕ ਬਸ ਇਸ ਨੂੰ ਚੱਖ ਕੇ ਵਧੀਆ ਸਮਝੀ ਜਾਏ ਅਤੇ ਪੰਜਾਬ ਦਾ ਨਾਮ ਵੀ ਮਸ਼ਹੂਰ ਹੋਏ ਗੁੜ ਅਤੇ ਗੁੜ ਦੇ ਚੱਖਣ ਵਾਸਤੇ ਅਤੇ ਗੁੜ ਨੂੰ ਪੈਦਾ ਕਰਨ ਵਾਸਤੇ